ਸਰਦੀਆਂ ਦਾ ਟੈਮ ਆਉਂਦਾ ਠੰਢ 'ਚ ਬਾਹਰ ਜਾਣਾ ਤਾਂ ਵੈਸੇ ਔਖਾ ਲੱਗਦਾ ਤਾਂ ਮੈਂ ਓਨਲੈਨ ਹੀ ਓਡਰ ਕਰ ਲੈਂਦਾ ਹੁੰਦਾ ਵੈਸੇ ਇਲੈਕਟਰੋਨਿਕ ਚੀਜ਼ਾਂ ਉਂ ਵਰੈਟੀ ਬਹੁਤ ਮਿਲ ਜਾਂਦੀ ਆ ਨਾ ਅਲੱਗ ਅਲੱਗ ਦੀ ਰੰਗ ਰੁੰਗ ਜਿੰਨੇ ਵੀ ਆਪਾਂ ਚੀਜ਼ ਕੰਪਨੀਆਂ ਅਲੱਗ ਅਲੱਗ ਮਿਲ ਜਾਂਦੀਆਂ ਰੇਟ ਦਾ ਫਰਕ ਪੈ ਜਾਂਦਾ ਆਪਾਂ ਨੂੰ ਅਤੇ ਮੈਂ ਯਾਰ ਹੈੱਡਫੋਨ ਕਰੇ ਸੀਗੇ ਓਡਰ ਓਨਲਾਈਨ ਅਤੇ ਦੇਖਣ ਨੂੰ ਉੱਥੇ ਤਾਂ ਬਹੁਤ ਵਧੀਆ ਲੱਗ ਰਹੇ ਸੀ ਵੀ ਪਤਾ ਨਹੀਂ ਹੈ ਨਾ ਕਿੰਨੇ ਕੁ ਵਧੀਆ ਸੀਗੇ ਬੋਟ ਕੰਪਨੀ ਦੇ ਸੀਗੇ 'ਚ ਰੀਵੀਊ ਵੀ ਵਧੀਆ ਦੇ ਰੱਖੇ ਸੀਗੇ ਹੁਣ ਇਹ ਨਹੀਂ ਪਤਾ ਉਹਨਾਂ ਨੇ ਧੱਕੇ ਨਾਲ ਆਪ ਹੀ ਦਵਾ ਰੱਖੇ ਕਿਸੇ ਤੋਂ ਤਾਂ ਓਡਰ ਕਰ ਲਏ ਮੈਂ ਓਡਰ ਕਰੇ ਵੇ ਮੈਂ ਓਨਲਾਈਨ ਹੀ ਪੇਮੈਂਟ ਕਰਤੀ ਸਾਰਾ ਆਪਾਂ ਹੈ ਨਾ ਸਾਰਾ ਪਹਿਲਾਂ ਹੀ ਉਹ ਕਰਤਾ ਸੀਗਾ ਅਤੇ ਆਏ ਖੋਲ੍ਹੇ ਯਾਰ ਖੋਲ੍ਹ ਵਧੀਆ ਸੀਗੇ ਨਾ ਦੇਖਣ ਨੂੰ ਵੀ ਵਧੀਆ ਅਤੇ ਮੈਂ ਚੈੱਕ ਕਰੇ ਕੁਆਲਟੀ ਸਾਊਂਡ ਕੁਆਲਿਟੀ ਇੰਨੀ ਬੇਕਾਰ ਇੰਨੀ ਘਟੀਆ ਕੁਛ ਕਹਿਣ ਦੀ ਹੱਦ ਨਹੀਂ ਬੇਸ ਬੂਸ ਕੁਛ ਨਹੀਂ ਹੈਗਾ ਬਾਜ ਚੱਕੋ ਕੰਬਣ ਲੱਗ ਜਾਂਦੇ ਸਪੀਕਰ ਜਿਹੇ ਉਹਦੇ ਅਤੇ ਉਹ ਵਾਪਿਸ ਕਰਨ ਲਈ ਉਹਨਾਂ ਨੇ ਰੀਪਲੇਸਮੈਂਟ ਪੁਆਈ ਰੀਪਲੇਸਮੈਂਟ ਪੁਆ ਕੇ ਮੰਗਵਾਏ ਦੂਜੇ ਉਹ ਉਹਤੋਂ ਵੀ ਫੁੱਦੂ ਐਨ ਬੇਕਾਰ ਜਮਾਂ ਹੀ ਮੈਂ ਕਹਿੰਦਾ ਚਲਾਏ ਕੰਬਿਆਂ ਕਰਨ ਸਾਰੇ ਉਹ ਤਾਰਾਂ ਏ ਖਿੱਚੀਆਂ ਕਰੇ ਟੁੱਟਣ ਵਾਲੀ ਬੰਦਾ ਐਂ ਲੱਗਦਾ ਟੁੱਟ ਜੂਗੀ ਤਾਰ ਉਹਦੇ ਹਲਕੀ ਜਿਹੀ ਖਿੱਚਣ 'ਤੇ ਮੈਨੂੰ ਐਂ ਵਰਕਆਊਟ 'ਤੇ ਪਾਉਣੇ ਹੁੰਦੇ ਨੇ ਉੱਥੇ ਥੋੜ੍ਹਾ ਬਹੁਤਾ ਖਿੱਚ ਵੀ ਜਾਂਦੇ ਚੀਜ਼ ਹੈ ਨਾ ਵਧੀਆ ਕੁਆਲਟੀ ਦੇ ਹੋਵੇ ਫਿਰ ਤਾਂ ਚੱਲੀ ਜਾਂਦੀ ਆ ਇੰਨੇ ਘਟੀਆ ਕੁਛ ਕਹਿਣ ਦੀ ਹੱਦ ਨਹੀਂ ਯਾਰ ਮੇਰਾ ਤਾਂ ਮੂਡ ਹੀ ਖ਼ਰਾਬ ਕਰਤਾ ਹੁਣ ਤਾਂ ਇਹੀ ਸੋਚੀ ਦਾ ਵੀ ਜਾ ਕੇ ਦੁਕਾਨ 'ਤੇ ਜਾਓ ਔਖੇ ਸੌਖੇ ਉੱਥੋਂ ਲੈ ਕੇ ਆਈਏ ਆਪਣਾ ਚੈੱਕ ਕਰੀ ਹੁੰਦੀ ਚੀਜ਼ ਅੱਖਾਂ ਸਾਹਮਣੇ ਹੁੰਦੀ ਆ ਵਧੀਆ ਮਿਲ ਜਾਂਦੀ ਆ ਓਨਲਾਈਨ ਦਾ ਫਾਈਦਾ ਫੂਦਾ ਕੋਈ ਹੈ ਨੀਗਾ ਇਹਦਾ ਬੇਕਾਰ ਕੰਮ ਹੀ ਹੈ